ਮੈਂ ਨਾ ਥੋੜ੍ਹੇ ਦਿਨ ਪਹਿਲਾਂ ਬੜੀ ਪਰੇਸ਼ਾਨ ਹੋ ਰਹੀ ਸੀ ਮੈਨੂੰ ਬੇਟੇ ਲਈ ਨਾ ਸੂਟ ਚਾਹੀਦਾ ਸੀ ਉਹਦੀ ਖਾਸ ਡਿਮਾਂਡ ਸੀ ਕਿ ਮੰਮਾ ਮੈਂ ਹੁਣ ਸਪਾਈਡਰ ਵਾਲਾ ਸੂਟ ਪਾਉਣਾ ਹੈ ਅਤੇ ਸਕੂਲ ਦੇ ਫੰਕਸ਼ਨ ਲਈ ਚਾਹੀਦਾ ਵੀ ਸੀਗਾ ਫੇਰ ਸਾਰੇ ਕਿਤੇ ਮਾਰਕਿਟ 'ਚ ਬਾਜ਼ਾਰ 'ਚ ਵੀ ਘੁੰਮ ਫਿਰ ਕੇ ਵੀ ਕਿਤੇ ਸੂਟ ਕਿਤੇ ਸੂਟ ਹੀ ਨਾ ਲੱਭੇ ਇੱਕ ਜਗ੍ਹਾ ਦੇਖਿਆ ਤਾਂ ਉਹ ਪਸੰਦ ਹੀ ਨਾ ਆਵੇ ਨਾ ਉਹਦੀ ਫੀਟਿੰਗ ਆਵੇ ਫੇਰ ਫਰੈਂਡ ਨੇ ਕਿਹਾ ਕਿ ਤੂੰ ਆਨਲਾਈਨ ਟਰਾਈ ਕਰ ਫੇਰ ਮੈਂ ਆਨਲਾਈਨ ਉਹ ਸੂਟ ਦੇਖਿਆ ਉਹ ਇੰਨੇ ਸਾਰੇ ਡਿਜ਼ਾਈਨ ਕਲਰ ਇੱਕੋ ਹੀ ਸਪਾਈਡਰ ਵਾਲੇ ਸੂਟ 'ਚ ਹੀ ਫਿਰ ਮੈਂ ਆਡਰ ਕਰਤਾ ਉਹ ਦੇਖੋ ਮੇਰੇ ਆਡਰ ਕਰਨ 'ਤੇ ਤਿੰਨ ਦਿਨ ਬਾਅਦ ਹੀ ਮੇਰੇ ਕੋਲ ਸੂਟ ਆ ਗਿਆ ਉਹ ਸੂਟ ਇੰਨਾ ਫੋਟੋ 'ਚ ਨਹੀਂ ਸੋਹਣਾ ਲੱਗ ਰਿਹਾ ਸੀ ਜਿੰਨਾ ਦੇਖਣ 'ਚ ਸੋਹਣਾ ਲੱਗਿਆ ਉਸ ਦਾ ਕਲਰ ਉਹਦਾ ਰੰਗ ਇੰਨਾ ਸੋਹਣਾ ਸੀ ਇੰਨਾ ਸੋਹਣਾ ਡਿਜ਼ਾਈਨ ਸੀ ਕਿ ਦੇਖਦੇ ਹੀ ਨਾ ਬਸ ਬੇਟੇ ਨੇ ਤਾਂ ਕਿਹਾ ਮੰਮਾ ਮੈਂ ਤਾਂ ਹੁਣੇ ਹੀ ਪਾਉਣਾ ਇਹ ਸੂਟ ਜਦ ਉਹਨੇ ਪਾ ਕੇ ਦੇਖਿਆ ਉਹਦੀ ਫਿਟਿੰਗ ਵੀ ਬਹੁਤ ਪਿਆਰੀ ਆਈ ਇੰਨਾ ਸੋਹਣਾ ਫਿੱਟ ਆਇਆ ਕਲਰ ਇੰਨਾ ਪਿਆਰਾ ਔਰ ਈਵਨ ਕਿ ਦੇਖੋ ਕਿ ਧੋਣ ਤੋਂ ਬਾਅਦ ਵੀ ਉਸਦਾ ਰੰਗ ਨਹੀਂ ਗਿਆ ਕੱਪੜਾ ਇੰਨਾ ਸੋਫਟ ਇੰਨਾ ਮੁਲਾਇਮ ਇੰਨਾ ਵਧੀਆ ਡਿਜ਼ਾਈਨ ਸੀ ਨਾ ਮੈਂ ਤਾਂ ਖੁਸ਼ ਹੋ ਗਈ ਇੱਦਾਂ ਦਾ ਸੂਟ ਲੈ ਕੇ ਇਹ ਤਾਂ ਚੰਗਾ ਕੀਤਾ ਮੇਰੀ ਫਰੈਂਡ ਨੇ ਕਹਿ ਤਾ ਅਤੇ ਮੈਂ ਲੈ ਲਿਆ ਔਰ ਇੰਨਾ ਵਧੀਆ ਇੰਨੀ ਜਲਦੀ ਮਿਲ ਗਿਆ ਮੈਨੂੰ ਟਾਈਮ 'ਤੇ ਮਿਲ ਗਿਆ ਬਹੁਤ ਵਧੀਆ ਸੂਟ ਸੀ ਉਹ